ਮੈਂ ਨਾ ਇੱਕ ਸਮਾਨ ਖਰੀਦਿਆ ਉਹ ਕੱਪੜਿਆਂ ਵਾਲੇ ਕੈਬਿਨ ਨਹੀਂ ਆਉਂਦੇ ਹੁੰਦੇ ਦਿਖਾਉਂਦੇ ਹੁੰਦੇ ਹੈ ਔਨਲਾਈਨ ਵੀ ਬੜਾ ਦਿਖਾਉਂਦੇ ਹੈ ਉਹ ਔਡਰ ਕਰਤਾ ਪ੍ਰਚੇਸ ਕਰਨ ਲਈ ਦਿਖਾਉਂਦੇ ਸੀ ਮੈਨੂੰ ਹਜ਼ਾਰ ਰੁਪਏ ਦੇ ਛੇ ਮਿਲੂੰਗੇ ਉਹਦੇ ਉੱਤੇ ਛੇ ਹੋਰ ਫ੍ਰੀ ਦਊਂਗੇ ਜਦੋ ਔਡਰ ਕੀਤਾ ਤਾਂ ਜਿਹੜੀ ਚੀਜ਼ ਨਿਕਲ ਕੇ ਆਈ ਆਏ ਹਾਏ ਮੈਂ ਦੇਖ ਕੇ ਤਾਂ ਮੱਥੇ 'ਤੇ ਹੱਥ ਹੀ ਮਾਰਾਂ ਆਹ ਕੀ ਆ ਗਿਆ ਮੈਂ ਔਰਡਰ ਕੁਛ ਕੀਤਾ ਮੈਨੂੰ ਦੇ ਕੁਛ ਦਿੱਤਾ ਉਹ ਮੈਨੂੰ ਦਿਖਾਉਂਦੇ ਸੀ ਉਹਦੇ ਵਿੱਚ ਕਿ ਉੱਪਰ ਵੀ ਜਿੱਪ ਹੈ ਅਤੇ ਅੱਗਿਓ ਦੀ ਵੀ ਖੁੱਲ੍ਹਦਾ ਜਿੱਪ ਹੈਗੀ ਹੈ ਬੜਾ ਸੋਹਣਾ ਕੈਬਿਨ ਦਿਖਾ ਰਹੇ ਅਤੇ ਉਹਦਾ ਕੱਪੜਾ ਵੀ ਇੰਨਾ ਵਧੀਆ ਦਿਖਾ ਰਹੇ ਸੀ ਅਤੇ ਦਿਖਾ ਰਹੇ ਸੀ ਟਰਾਂਸਪ੍ਰੈਂਟ ਹੈ ਆਰ ਪਾਰ ਦਿੱਖਦਾ ਰਹੂੰਗਾ ਕਿ ਕਿੱਥੇ ਕੀ ਚੀਜ਼ ਪਈ ਹੈ ਬਹੁਤਾ ਲੱਭਣ ਦੀ ਲੋੜ ਨਹੀਂ ਪੈਣੀ ਪਰ ਜਦੋਂ ਮੈਂ ਉਹ ਦੇਖਿਆ ਉਹ ਨਾ ਤਾਂ ਆਰ ਪਾਰ ਸੀ ਨਾ ਅੱਗੇ ਜਿੱਪ ਸੀ ਨਾ ਉਹ ਤੋਂ ਦਿੱਖਦਾ ਸੀ ਨਾ ਵਧੀਆ ਕੁਆਲਿਟੀ ਸੀ ਜਿਹੜੀਆਂ ਗੱਲਾਂ ਕਹੀਆਂ ਸਾਰਾ ਹੀ ਗਲਤ ਸਾਰਾ ਕੁਛ ਗਲਤ ਇੱਕ ਤਾਂ ਸਾਰੇ ਪੈਸੇ ਖਰਾਬ ਹੋਏ ਟਾਈਮ ਖਰਾਬ ਹੋਇਆ ਇੱਕ ਬੇਕਾਰ ਦੀ ਚੀਜ਼ ਮੇਰੇ ਮੱਥੇ ਪੈ ਗਈ ਹੁਣ ਕੀ ਬੰਦਾ ਪ੍ਰਚੇਸ ਕਰੇ ਕੀ ਖਰੀਦੇ ਦਿਮਾਗ ਖਰਾਬ ਹੋ ਗਿਆ ਹੁਣ ਤਾਂ ਐਂ ਜੀਅ ਕਰਦਾ ਹੈ ਕਿ ਏਦਾਂ ਦੀ ਚੀਜ਼ ਨਾ ਨਾ ਬੰਦਾ ਲਵੇ ਹੀ ਨਾ ਇਹਨਾਂ ਦਾ ਕੋਈ ਭਰੋਸਾ ਹੀ ਨਾ ਕਰੇ ਹੁਣ ਮੈਂ ਕਿਆ ਕਰਾਂ ਹੁਣ ਉਹ ਸਾਰਾ ਸਮਾਨ ਮੈਂ ਏਦਾਂ ਹੀ ਉਹ ਖੁੰਜੇ ਵਾੜ ਕੇ ਰੱਖਿਆ ਹੋਇਆ ਹੈ ਕਿਸੇ ਕੰਮ ਹੀ ਨਹੀਂ ਆਉਣਾ ਉਹ ਤਾਂ